ਸਰਕਾਰ ਸਾਡੇ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਜਾਗਰੂਕਤਾ ਕੈਂਪ ਨਸ਼ੇ ਤੋਂ ਜਾਗਰੂਕਤਾ ਵਿੱਦਿਅਕ ਬਾਰੇ ਅਤੇ ਸਿਹਤ ਬਾਰੇ ਜਾਗਰੂਕਤਾ ਕੈਂਪ ਆਮ ਤੌਰ 'ਤੇ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਲਗਾਉਂਦੀ ਹੀ ਰਹਿੰਦੀ ਹੈ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਸਾਨੂੰ ਪਿੰਡਾਂ ਦੇ ਲੋਕਾਂ ਨੂੰ ਸਾਨੂੰ ਆਮ ਲੋਕਾਂ ਨੂੰ ਇਸ ਬਿਮਾਰੀਆਂ ਤੋਂ ਜਾਗਰੂਕ ਕਰਦੀ ਰਹਿੰਦੀ ਹੈ ਅਤੇ ਸਾਨੂੰ ਨਾਲ ਨਾਲ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਵੀ ਇਸ ਦਾ ਕਿਵੇਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ ਬੱਚਿਆਂ ਦੇ ਸਕੂਲਾਂ ਦੇ ਵਿੱਚ ਵੀ ਇਹ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਆਮ ਤੌਰ 'ਤੇ ਸਾਡੇ ਪਿੰਡਾਂ ਦੇ ਵਿੱਚ ਜੋ ਧਰਮਸ਼ਾਲਾ ਬਣੀਆਂ ਹੁੰਦੀਆਂ ਹਨ ਜਾਂ ਪੰਚਾਇਤ ਘਰ ਬਣੇ ਹੁੰਦੇ ਹਨ ਜਾਂ ਆਂਗਨਵਾੜੀ ਸੈਂਟਰ ਹੁੰਦੇ ਹਨ ਜਾਂ ਪੰਚਾ ਪੰਚਾਇਤ ਦੀ ਸਾਂਝੀ ਜਗ੍ਹਾ ਦੇ ਉੱਤੇ ਇਹ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਜਾਗਰੂਕਤਾ ਕੈਂਪਾਂ ਦੇ ਨਾਲ ਨਾਲ ਨਾਟਕ ਦੁਆਰਾ ਵੀ ਪੇਸ਼ਕਾਰੀ ਬਿਮਾਰੀਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਨਾਟਕ ਪੇਸ਼ ਕੀਤੇ ਜਾਂਦੇ ਹਨ ਡਾਕਟਰਾਂ ਦੀ ਟੀਮ ਆਉਂਦੀ ਹੈ ਡਾਕਟਰ ਹਰੇਕ ਚੀਜ਼ ਤੋਂ ਸਾਨੂੰ ਬਚਣ ਲਈ ਉਸਦੇ ਕਾਰਨ ਉਸਦੇ ਬਚਾਅ ਦੇ ਕਾਰਨ ਉਸ ਬਿਮਾਰੀ ਦੇ ਆਉਣ ਦੇ ਬਾਰੇ ਜਾਣਕਾਰੀ ਸਾਰੀ ਤਰ੍ਹਾਂ ਦੀ ਜਾਣਕਾਰੀ ਦਿੰਦੇ ਹਨ ਤਾਂ ਕਿ ਪਿੰਡਾਂ ਦੇ ਵਿੱਚ ਅਨਪੜ੍ਹਤਾ ਕਾਫੀ ਜ਼ਿਆਦਾ ਹੁੰਦੀ ਹੈ ਪਿੰਡਾਂ ਦੇ ਬਜ਼ੁਰਗ ਲੋਕ ਕਾਫੀ ਅਨਪੜ੍ਹ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਨਾ ਬਿਮਾਰੀਆਂ ਬਾਰੇ ਉਹ ਇਹਨਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹੀ ਪਿੰਡਾਂ ਦੇ ਵਿੱਚ ਕੈਂਪ ਲਾਉਂਦੇ ਆ ਤਾਂ ਕਿ ਲੋਕ ਇਸ ਬਿਮਾਰੀ ਤੋਂ ਸਮੇਂ ਦੇ ਨਾਲ ਨਾਲ ਹੀ ਜਾਗਰੂਕ ਹੋ ਜਾਣ ਅਤੇ ਇਸ ਬਿਮਾਰੀ ਨੂੰ ਗੰਭੀਰ ਰੂਪ ਵਿਕਾਰਾਂ ਪੇ ਗੰਭੀਰ ਰੂਪ ਪੈਦਾ ਹੋਣ ਤੋਂ ਪਹਿਲਾਂ ਪਹਿਲਾਂ ਹੀ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ ਅਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਜਿਵੇਂ ਕਿ ਕਰੋਨਾ ਬਾਰੇ ਕੈਂਪ ਲਗਾਏ ਜਾਂਦੇ ਹਨ ਮਲੇਰੀਆ ਬਾਰੇ ਕੈਂਪ ਲਗਾਏ ਜਾਂਦੇ ਹਨ ਪਿੰਡਾਂ ਵਿੱਚ ਹੋਰ ਵੀ ਜਿਹੜੀਆਂ ਏਡਸ ਬਿਮਾਰੀਆਂ ਬਿਮਾਰੀਆਂ ਬਾਰੇ ਵੀ ਕੈਂਪ ਲਗਾਏ ਜਾਂਦੇ ਹਨ ਤਾਂ ਕਿ ਲੋਕ ਇਸ ਬਿਮਾਰੀਆਂ ਤੋਂ ਬਚ ਸਕਣ